ਹਾਂਜੀ ਮੈਨੂੰ ਇੱਕ ਤਕਨੀਕੀ ਮੁਸ਼ਕਲ ਬਾਰੇ ਪਤਾ ਹੈ ਜੋ ਕਿ ਕਈ ਵਾਰ ਰੇਤ ਦੀ ਪ੍ਰੋਬਲਮ ਆ ਜਾਂਦੀ ਹੈ ਉਸ ਨੂੰ ਆਪਾਂ ਸਹੀ ਕਰਵਾ ਸਕਦੇ ਹਾਂ ਅਤੇ ਇਹ ਤਕਨੀਕੀ ਮੁੱਦੇ ਹੱਲ ਹੋ ਸਕਦੇ ਹਨ ਅਤੇ ਮੈਂ ਉਹਨਾਂ ਦੀ ਮਦਦ ਇਹਨਾਂ ਨੂੰ ਸਹੀ ਕਰਵਾ ਕੇ ਕਰ ਸਕਦਾ ਹਾਂ